ਮੈਂ ਅੰਮ੍ਰਿਤਸਰ ਜਾਣਾ ਸਭ ਤੋਂ ਜ਼ਿਆਦਾ ਪਸੰਦ ਕਰਦੀ ਹਾਂ ਕਿਉਂਕਿ ਉੱਥੇ ਵਧੀਆ ਸਫਾਈ ਸੇਵਕਾ ਹੈ ਕਿਉਂਕਿ ਉੱਥੇ ਵਧੀਆ ਰੋਣਕ ਮੇਲਾ ਲੱਗਦਾ ਹੈ ਉੱਥੇ ਗੁਰਦੁਆਰਾ ਵਧੀਆ ਗੁਰਦੁਆਰੇ ਦੇ ਦਰਸ਼ਨ ਹੁੰਦੇ ਆ ਉੱਥੇ ਜਲ੍ਹਿਆਂਵਾਲਾ ਬਾਗ ਆ ਵਾਹਗਾ ਬਾਰਡਰ ਬਜ਼ਾਰ ਬਹੁਤ ਬਾਜ਼ਾਰ 'ਚ ਬਹੁਤ ਵਧੀਆ ਰੌਣਕ ਆ ਬਜ਼ਾਰ 'ਚ ਬਹੁਤ ਚੀਜ਼ਾਂ ਵਧੀਆ ਹਨ ਜੋ ਕਿ ਸਾਨੂੰ ਆਮ ਬਜ਼ਾਰਾਂ 'ਚ ਨਹੀਂ ਮਿਲਦੀ ਕਿਉਂਕਿ ਅੰਮ੍ਰਿਤਸਰ ਨੂੰ ਦੇ ਅੰਮ੍ਰਿਤਸਰ ਜਾ ਕੇ ਸਾਨੂੰ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਹਾਂ ਅਤੇ ਉੱਥੇ ਜਾ ਕੇ ਸਾਨੂੰ ਬਹੁਤ ਵਧੀਆ ਸ਼ਾਂਤੀ ਮਿਲਦੀ ਆ ਸਾਡੇ ਮਨ ਨੂੰ ਬਹੁਤ ਖੁਸ਼ੀ ਸ਼ਾਂਤੀ ਮਿਲਦੀ ਹੈ ਅਤੇ ਅਸੀਂ ਉੱਥੇ ਜ਼ਲ੍ਹਿਆਂਵਾਲੇ ਬਾਗ ਦਿਨ ਜ਼ਲ੍ਹਿਆਂਵਾਲੇ ਬਾਗ 'ਚ ਬਹੁਤ ਜ਼ਿਆਦਾ ਅਸੀਂ ਜਿੱਥੇ ਭਗਤ ਸਿੰਘ ਵਰਗਿਆਂ ਦੇ ਗੋਲੀਆਂ ਵੱਜੀਆਂ ਸੀ ਉੱਥੇ ਪਾਰਕ ਵੀ ਬਹੁਤ ਵਧੀਆ ਉੱਥੇ ਸਾਨੂੰ ਬਹੁਤ ਚੀਜ਼ਾਂ ਜਿੱਥੇ ਉਹਨਾਂ ਦੇ ਗੋਲੀਆਂ ਵੱਜੀਆਂ ਸੀ ਉਹਨਾਂ ਦੇ ਬਾਰੇ ਬਹੁਤ ਵਧੀਆ ਜਾਣਕਾਰੀ ਮਿਲਦੀ ਆ ਅਤੇ ਵਾਹਗਾ ਬਾਰਡਰ ਵਿੱਚ ਫੌਜ ਫੌਜ ਜੋ ਟ੍ਰੇਨ ਕਰਦੇ ਆ ਉਹਨਾਂ ਬਾਰੇ ਉਹਨਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਦਾ ਸਾਨੂੰ ਅਤੇ ਅਸੀਂ ਉਹਨਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਸਾਡਾ ਜੀਅ ਕਰਦਾ ਅਸੀਂ ਅੰਮ੍ਰਿਤਸਰ ਸਾਹਿਬ ਜਾ ਕੇ ਮੈਨੂੰ ਵੀ ਜ਼ਿਆਦਾ ਤੋਂ ਜ਼ਿਆਦਾਤਰ ਅੰਮ੍ਰਿਤਸਰ ਜਾਣਾ ਬਹੁਤ ਵਧੀਆ ਲੱਗਦਾ ਕਿਉਂਕਿ ਅੰਮ੍ਰਿਤਸਰ ਜਾ ਕੇ ਸਾਨੂੰ ਐਨੀ ਖੁਸ਼ੀ ਮਿਲਦੀ ਆ ਕਿ ਅਸੀਂ ਬਹੁਤ ਉੱਥੇ ਸਾਨੂੰ ਚੀਜ਼ਾਂ ਵੀ ਇਹੋ ਜਿਹੀਆਂ ਬਹੁਤ ਵਧੀਆ ਮਿਲਦੀਆਂ ਹਨ ਜਿਨ੍ਹਾਂ ਨਾਲ ਸਾਡੇ ਜਾਣਕਾਰੀ ਬਹੁਤ ਵੱਧ ਸਾਡੀ ਬਹੁਤ ਜ਼ਿਆਦਾ ਜਾਣਕਾਰੀ ਮਿਲਦੀ ਆ ਵਾਹਗਾ ਬਾਰਡਰ 'ਚ ਵੀ ਅੰਮ੍ਰਿਤਸਰ ਜਾ ਕੇ ਵਧੀਆ ਇਸ਼ਨਾਨ ਲੰਗਰ ਪਾਣੀ ਬਹੁਤ ਵਧੀਆ ਹੁੰਦਾ ਉੱਥੇ ਦਿਵਸ ਉੱਥੇ ਦੀ ਬਹੁਤ ਉੱਥੇ ਬਹੁਤ ਜ਼ਿਆਦਾ ਸ਼ਾਂਤੀ ਆ ਉੱਥੇ ਕੋਈ ਵੀ ਧੂੜ ਧਪੱਕਾ ਹੈ ਨਹੀਂ ਐਵੇਂ ਦਾ ਉੱਥੇ ਸਭ ਸਭ ਦੇ ਸਿਰਾਂ ਉੱਤੇ ਪੱਗਾਂ ਹਨ ਸਰਦਾਰ ਹੁੰਦੇ ਆ ਅਤੇ ਸਾਨੂੰ ਉਹ ਦੇਖ ਕੇ ਬਹੁਤ ਵਧੀਆ